ਹਾਂ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਪ੍ਰਣਾਲੀ ਹੈ ਮੈਨੂੰ ਲੱਗਦਾ ਹੈ ਕਿ ਉਹ ਇੱਕ ਜ਼ੀਰੋ ਲੈਵਲ ਤੋਂ ਸ਼ੁਰੂ ਹੋ ਕੇ ਸਟੈਪ ਬਾਈ ਸਟੈਪ ਉਹ ਬੜੇ ਅੱਛੇ ਪ੍ਰਫੋਮੇ 'ਤੇ ਹੁਣ ਪਹੁੰਚ ਚੁੱਕੀ ਹੈ ਜਿਵੇਂ ਕਿ ਪੰਜਾਬ ਵਿੱਚ ਅਸੀਂ ਜਾਣਦੇ ਹਾਂ ਬਹੁਤ ਸਾਰੀਆਂ ਕਾਲਜ ਯੂਨੀਵਸਟੀਆਂ ਔਰ ਬਹੁਤ ਸਾਰੇ ਸਕੂਲ ਸੰਸਥਾਵਾਂ ਐਸੀਆਂ ਹਨ ਜੋ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਉਨ੍ਹਾਂ ਦਾ ਸਰਵਪੱਖੀ ਵਿਕਾਸ ਕਿਵੇਂ ਕਰਨਾ ਸਰਵਪੱਖੀ ਵਿਕਾਸ ਦੇ ਵਿੱਚ ਜਿਵੇਂ ਸਾਡਾ ਸਮਾਜਿਕ ਵਿਕਾਸ ਸਰੀਰਿਕ ਵਿਕਾਸ ਮਾਨਸਿਕ ਵਿਕਾਸ ਇਹ ਸਾਰੀਆਂ ਚੀਜਾਂ ਆ ਜਾਂਦੀਆਂ ਹਨ ਔਰ ਮੈਨੂੰ ਲੱਗਦਾ ਹੈ ਕਿ ਜਿਹੜੀਆਂ ਵਿੱਦਿਅਕ ਸੰਸਥਾਵਾਂ ਵਾਂ ਉਨ੍ਹਾਂ ਦਾ ਬੱਚੇ ਦੀ ਆਲਰਾਊਂਡ ਡਿਵੈਲਪਮੈਂਟ ਸਰਵਪੱਖੀ ਵਿਕਾਸ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਪੰਜਾਬ ਦੇ ਵਿੱਚ ਸਿੱਖਿਆ ਪ੍ਰਣਾਲੀ ਜਿਵੇਂ ਅਸੀਂ ਜਾਣਦੇ ਹਾਂ ਕਿ ਸ਼ੁਰੂ 'ਚ ਗੁਰੂਕੁਲ ਹੁੰਦੇ ਰਹੇ ਹੈ ਮੱਠ ਹੁੰਦੇ ਰਹੇ ਹੈ ਉਨ੍ਹਾਂ ਦੇ ਵਿੱਚ ਬੱਚਿਆਂ ਦੀ ਸਿੱਖਿਆ ਪ੍ਰਣਾਲੀ ਕੀਤੀ ਜਾਂਦੀ ਰਹੀ ਹੈ ਲੇਕਿਨ ਅੱਜ ਦੇ ਟਾਈਮ ਵਿੱਚ ਬੱਚਿਆਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਸਾਰੇ ਸੁਧਾਰ ਕੀਤੇ ਗਏ ਹੈ ਜਿਵੇਂ ਅੱਠਵੀਂ ਕਲਾਸ ਤੱਕ ਮੁਫ਼ਤ ਅਤੇ ਲਾਜ਼ਮੀ ਸਿੱਖਿਆ ਐਕਟ ਜਿਹੜਾ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਜਿਹਦੇ ਵਿੱਚ ਅੱਠਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਫ੍ਰੀ ਜਿਹੜੀ ਹੈ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਬੱਚਿਆਂ ਨੂੰ ਮੈਨੂੰ ਲੱਗਦਾ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਕਾਲਜ ਯੂਨੀਵਸਟੀਆਂ ਇਹਨਾਂ ਨੇ ਜਿਹੜੀ ਸਾਡੇ ਪੰਜਾਬ ਦੀ ਸਾਖਰਤਾ ਦਰ ਆ ਉਹਨੂੰ ਕਾਫ਼ੀ ਉੱਪਰ ਚੁੱਕਣ ਵਿੱਚ ਯੋਗਦਾਨ ਪਾਇਆ ਵਾ ਜਿਵੇਂ ਕਿ ਅਸੀਂ ਜਾਣਦੇ ਕਿ ਅੱਜ ਤੋਂ ਜੇ ਅਸੀਂ ਤੀਹ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੀ ਸਾਖਰਤਾ ਦਰ ਮੈਨੂੰ ਲੱਗਦਾ ਲਗਭਗ ਤੀਹ ਪਰਸੈਂਟ ਸੀ ਔਰ ਇਨ੍ਹਾਂ ਕਾਲਜ ਯੂਨੀਵਸਟੀਆਂ ਦੇ ਸਦਕਾ ਇਨ੍ਹਾਂ ਦੀਆਂ ਪ੍ਰਾਪਤੀਆਂ ਸਦਕਾ ਇਨ੍ਹਾਂ ਦੀ ਮਿਹਨਤ ਸਦਕਾ ਇਨ੍ਹਾਂ ਦੇ ਜੋ ਅਧਿਆਪਕ ਨੇ ਉਨ੍ਹਾਂ ਦੀ ਮਿਹਨਤ ਸਦਕਾ ਜਿਹੜੀ ਸਾਡੀ ਸਿੱਖਿਆ ਦਰ ਹੈ ਪੰਜਾਬ ਦੀ ਉਹ ਅੱਜ ਦੇ ਟਾਈਮ ਵਿੱਚ ਪੰਜਾਹ ਤੋਂ ਪਚਵੰਜਾ ਪਰਸੈਂਟ ਜਿਹੜੀ ਹੈ ਉਹ ਹੋ ਚੁੱਕੀ ਹੈ ਜਿਹੜੇ ਕਾਰਨ ਮੈਨੂੰ ਲੱਗਦਾ ਕਿ ਪੰਜਾਬ ਦੇ ਸਕੂਲ ਕੋਲੇਜ ਯੂਨੀਵਸਟੀਆਂ ਉਨ੍ਹਾਂ ਨੇ ਪੰਜਾਬ ਦੀ ਸਾਖਰਤਾ ਦਰ ਨੂੰ ਵਧਾਉਣ ਵਿੱਚ ਕਾਫ਼ੀ ਸਾਰੀ ਅੱਛੀ ਭੂਮਿਕਾ ਨਿਭਾਈ ਆ ਜੋ ਕਿ ਇਨ੍ਹਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਵੀ ਐਸੁਈ ਐਸੀ ਭੂਮਿਕਾ ਨਿਭਾਉਂਦੇ ਰਹਿਣ ਔਰ ਸਾਡੇ ਜਿਹੜੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੇ ਰਹਿਣ ਧੰਨਵਾਦ